ਮੈਂ ਆਰਟ ਐਂਡ ਕਰਾਫਟ ਦਾ ਕੋਰਸ ਕੀਤਾ ਹੈ ਜੋ ਕਿ ਅੱਜ ਤੋਂ ਮੈਂ ਕੋਈ ਪੰਦਰ੍ਹਾਂ ਸਾਲ ਪਹਿਲਾਂ ਕੀਤਾ ਸੀ ਉਹਦੇ ਵਿੱਚ ਮੈਨੂੰ ਬਹੁਤ ਵਧੀਆ ਕਰਨ ਨੂੰ ਮਿਲਿਆ ਉਹਦੇ ਵਿੱਚ ਮੇਰਾ ਬਹੁਤ ਇੰ ਪੇਂਟਿੰਗ ਵਿੱਚ ਮੇਰਾ ਬਹੁਤ ਇੰਟਰਸਟ ਸੀ ਇਹਦੇ ਉਸ ਟਾਈਮ ਮੈਂ ਇੱਕ ਲੈਂਡਸਕੇਪ ਬਣਾਇਆ ਸੀ ਲੈਂਡਸਕੇਪ ਜੋ ਮੈਂ ਬਣਾਇਆ ਸੀ ਬਹੁਤ ਵਧੀਆ ਬਹੁਤ ਸੋਹਣਾ ਬਣਿਆ ਸੀ ਉਸ ਵਿੱਚ ਅਸੀਂ ਪੈਂਸਲ ਕਲਰ ਕੀਤੇ ਸੀ ਜੋ ਕਿ ਬਹੁਤ ਹੀ ਪਿਆਰੇ ਹੋਏ ਸੀ ਉਹ ਮੇਰੀ ਪੇਂਟਿੰਗ ਬਹੁਤ ਵਧੀਆ ਬਣੀ ਸੀ ਬਹੁਤ ਵਧੀਆ ਅਸੀਂ ਲੈਂਡਸਕੇਪ ਬਣਾਇਆ ਨਾਲ ਰੀਵਰ ਬਣਾਈ ਸੀ ਨਾਲ ਹੱਟ ਬਣਾਈ ਸੀ ਉਸ ਵਿੱਚ ਮੈਂ ਜੋ ਕਲਰ ਕੀਤੇ ਉਸਦੀ ਸਭ ਨੇ ਤਾਰੀਫ਼ ਕੀਤੀ ਸੀ ਮੈਡਮ ਨੇ ਮੇਰੀ ਨੇ ਮੈਨੂੰ ਬਹੁਤ ਵਧੀਆ ਉਸਦੀ ਤਰੀਫ਼ ਕੀਤੀ ਸਾਰੀ ਕਲਾਸ ਵਿੱਚ ਦਿਖਾਈ ਮੇਰੇ ਲੈ ਪੇਂਟਿੰਗ ਬਹੁਤ ਸੋਹਣੀ ਬਣੀ ਸੀ ਮੇਰੇ ਫਰੈਂਡਸ ਨੂੰ ਵੀ ਉਹ ਪੇਂਟਿੰਗ ਮੇਰੀ ਬਹੁਤ ਪਸੰਦ ਆਈ ਉਹਨਾਂ ਨੂੰ ਵੀ ਸਾਰਿਆਂ ਨੇ ਮੇਰੀ ਉਸ ਪੇਂਟਿੰਗ ਬਾਰੇ ਤਰੀਫ਼ ਕੀਤੀ ਮੇਰੇ ਖਿਆਲ ਸੀ ਪਰ ਸਰ ਕੋਲ ਵੀ ਮੇਰੀ ਪੇਂਟਿੰਗ ਮੈਮ ਲੈ ਕੇ ਗਏ ਉਹਨਾਂ ਨੂੰ ਵੀ ਮੇਰੀ ਪੇਂਟਿੰਗ ਬਹੁਤ ਪਸੰਦ ਆਈ ਉਹ ਵਾਲੀ ਪੇਂਟਿੰਗ ਮੇਰੀ ਉਹਨਾਂ ਨੇ ਨੋਟਿਸ ਬੋਰਡ ਉੱਪਰ ਲਗਾਈ ਜਿਸ ਉੱਪਰ ਮੈਨੂੰ ਬਹੁਤ ਜ਼ਿਆਦਾ ਵਧੀਆ ਫੀਲ ਹੋਇਆ ਜੀ ਫੀਲ ਹੋਇਆ ਮੈਨੂੰ ਆਪਣੇ ਆਪ ਤੋਂ ਇਹ ਉਮੀਦ ਹੋਈ ਕਿ ਮੈਂ ਇਸ ਕੰਮ ਵਿੱਚ ਇਸ ਤੋਂ ਵੀ ਅੱਗੇ ਬੈਟਰ ਕੁਛ ਕੰਮ ਕਰ ਸਕਦੀ ਹਾਂ ਜਿਸ ਵਿੱਚ ਮੈਨੂੰ ਇੰਨਾ ਉਤਸ਼ਾਹ ਹੋਇਆ ਕਿ ਮੈਂ ਹੋਰ ਵੀ ਇਸ ਤੋਂ ਵਧੀਆ ਪੇਂਟਿੰਗ ਬਣਾ ਸਕਦੀ ਹਾਂ ਮੇਰਾ ਕੰਮ ਇਸ ਵਿੱਚ ਬਹੁਤ ਹੀ ਵਧੀਆ ਚੱਲ ਸਕਦਾ ਹੈ ਉਹ ਯਾਦਗਾਰੀ ਪਲ ਮੈਨੂੰ ਅੱਜ ਵੀ ਯਾਦ ਹਨ